ਹੈਲੋ ਸਰ ਸਰਵਨ ਸਰ ਬੋਲਦੇ ਹੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਨਾ ਆਪਣੇ ਬੱਚੇ ਨੂੰ ਤੁਹਾਡੇ ਕੋਲ ਲਾਇਆ ਸੀਗਾ ਸੰਗੀਤ ਸਿੱਖਣ ਵਾਸਤੇ ਹਾਂਜੀ ਅਤੇ ਉਹ ਹੁਣ ਉਹਦੇ 'ਚ ਬਦਲਾ ਆ ਰਿਹਾ ਕੋਈ ਹਾਂਜੀ ਹਾਂਜੀ

ਹਾਂਜੀ ਹਾਂਜੀ ਸਰ ਸੰਗਦਾ ਤਾਂ ਸਰ ਘਰ ਵੀ ਇਹ ਬਹੁਤ ਸੀ ਜੀ ਜਦੋਂ ਕੋਈ ਰਿਸ਼ਤੇਦਾਰ ਆ ਜਾਂਦਾ ਸੀ ਤਾਂ ਅੰਦਰੋਂ ਨਹੀਂ ਨਿਕਲਦਾ ਸੀ ਸਰ ਇਹ ਬਹੁਤ ਹੀ ਜ਼ਿਆਦੇ ਸੰਗਦਾ ਸੀਗਾ ਅਤੇ ਅਤੇ ਤਾਂ ਹੀ ਤਾਂ ਤੁਹਾਡੇ ਕੋਲ ਲਾਇਆ ਸੀ ਵੀ ਚਲੋ ਇਹਦੀ ਸੰਗ ਖੁੱਲ੍ਹ ਜੂਗੀ

ਹਾਂਜੀ

ਹਾਂਜੀ ਸਰ ਵੈਸੇ ਤਾਂ ਅਸੀਂ ਵੀ ਅਸੀਂ ਵੀ ਅਸੀਂ ਵੀ ਘਰ ਇਹਨੂੰ ਬਹੁਤ ਸਹਿਯੋਗ ਦਿੰਦੇ ਹਾਂ ਸਰ ਨਾਲ ਅਤੇ ਵੀ ਘਰ ਵੀ ਬਹੁਤ ਆ ਕੇ ਰਿਆਜ਼ ਕਰਦਾ ਇਹ ਇਹ ਦੋ ਦੋ ਦੋ ਘੰਟੇ ਸੁਬਾਹ ਦੋ ਤਿੰਨ ਘੰਟੇ ਸ਼ਾਮ ਨੂੰ ਵੀ ਇੱਦਾਂ ਰਿਆਜ਼ ਬਹੁਤ ਕਰਦਾ ਹੈਗਾ ਅਤੇ ਅਸੀਂ ਵੀ ਇਹਦਾ ਬਹੁਤ ਸਹਿਯੋਗ ਦਿੰਦੇ ਹਾਂ ਇਸ ਗੱਲ ਵਿੱਚ

ਹਾਂਜੀ ਹਾਂਜੀ ਹਾਂਜੀ ਹਾਂਜੀ

ਬਹੁਤ ਬਹੁਤ ਧੰਨਵਾਦ ਸਰ ਸਤਿ ਸ਼੍ਰੀ ਅਕਾਲ ਜੀ